ਹੈਲੋ ਹੈਲੋ ਹਾਂਜੀ ਦਿਨੇਸ਼ ਕੈਟਰਿੰਗ ਵਾਲੇ ਬੋਲਦੇ ਉ ਜੀ ਸਤਿ ਸ਼੍ਰੀ ਅਕਾਲ ਜੀ ਗੱਲ ਐਂ ਐ ਜੀ ਮੈਂ ਆਪਣੇ ਬੇਟੇ ਦੀ ਅਗੇਜ਼ਮੈਂਟ ਤੱਕ ਚਾਲੀ ਕੁ ਬੰਦਿਆਂ ਦਾ ਕੈਟਰਿੰਗ ਦਾ ਕਰਨਾ ਪ੍ਰਬੰਧ ਉਹਦੇ ਬਾਰੇ ਸਾਨੂੰ ਦੱਸੋ ਕੀ ਰੇਟ ਹੋਊਗਾ ਅਸੀਂ ਚਾਹੁੰਦੇ ਹਾਂ ਵੀ ਜਿਵੇਂ ਚਾਹ ਦੇ ਵਿੱਚ ਇੱਕ ਤਾਂ ਪਕੌੜੇ ਵਗੈਰਾ ਹੋ ਗਏ ਸਾਰੇ ਪਾਲਕ ਵਾਲੇ ਗੋਭੀ ਵਾਲੇ ਅਤੇ ਪਨੀਰ ਵਾਲੇ ਪਕੌੜੇ ਹੋਣ ਗੁਲਾਬ ਜਾਮਣ ਗਜਰੇਲਾ ਵਗੈਰਾ ਮਿੱਠਾ ਹੋਵੇ ਜੀ ਕੋਲ ਹਾਂ ਕੌਫੀ ਕੋਲਡ ਡਰਿੰਕ ਹੋ ਗਿਆ ਜੀ ਫਿਰ ਇੱਦਾਂ ਹੀ ਲੰਚ ਦੇ ਵਿੱਚ ਸ਼ਾਹੀ ਪਨੀਰ ਹੋ ਜਵੇ ਇੱਕ ਅੱਧਾ ਹੋਰ ਪਨੀਰ ਦੀ ਕੋਈ ਆਈਟਮ ਕਰ ਦਿਉ ਦਾਲ ਹੋਜੂਗੀ ਮਿਕਸ ਸਬਜ਼ੀ ਦਹੀਂ ਵਗੈਰਾ ਹੋ ਜਵੇ ਜੀ ਅਤੇ ਬਾਕੀ ਜਿਹੜੇ ਬੰਦੇ ਬੁੰਦੇ ਆ ਕੈਟਰਿੰਗ ਆਹ ਬਹਿਰੇ ਵਗੈਰਾ ਕਿਵੇਂ ਹੋਣਗੇ ਕਿੰਨਾਂ ਕੁ ਤੁਹਾਡਾ ਰੇਟ ਆ ਉਹਦੇ ਬਾਰੇ ਸਾਨੂੰ ਸਾਰਾ ਦੱਸੋ ਉਹਦੇ ਬਾਰੇ ਜਾਣਕਾਰੀ ਦਓ ਹਾਜੀ ਹਾਂ ਉਹ ਤਾਂ ਤੁਹਾਡਾ ਨੰਬਰ ਮੇਰੇ ਦੋਸਤ ਨੇ ਦਿੱਤਾ ਸੀ ਤਾਂ ਹੀ ਤੁਹਾਡੇ ਨਾਲ ਗੱਲ ਕਰੀ ਠੀਕ ਹੈ ਜੀ

ਠੀਕ ਹੈ ਜੀ ਮਤਲਬ ਦੇਖੋ ਜੀ ਗੱਲ ਐਕਣਾ ਇੱਕ ਤਾਂ ਵੇਟਰ ਜਿਹੜੇ ਸਾਫ ਸੁਥਰੇ ਹੋਣ ਚਿਹਰਾ ਵਗੈਰਾ ਸਾਫ ਹੋਣ ਤਾਂ ਕਿ ਪਤਾ ਕਿ ਗੱਲ ਹੈਗੀ ਦੇਖੋ ਅਸੀਂ ਆਪ ਤਾਂ ਕਰਨਾ ਨਹੀਂ ਠੇਕੇ 'ਤੇ ਹੀ ਕਰਾਉਣਾ ਹਾਂ ਨਾ ਪਲੇਟ ਸਿਸਟਮੇ ਕਰਾਂਗੇ ਜੀ ਬਾਕੀ ਤੁਸੀਂ ਫਿਰ ਐ ਕਰਦੇ ਹਾਂ ਆਪਾਂ ਤੁਸੀਂ ਸਮਾਨ ਦੀ ਗਰੰਟੀ ਹੋਣੀ ਚਾਹੀਦੀ ਤੁਹਾਡੀ ਵਧੀਆ ਉਹ ਬਣਿਆ ਹੋਣਾ ਚਾਹੀਦਾ

ਠੀਕ ਹੈ ਜੀ ਅਸੀਂ ਕੱਲ੍ਹ ਫਿਰ ਆ ਕੇ ਤੁਹਾਨੂੰ ਮਿਲਦੇ ਆ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ